ਵੱਖ ਵੱਖ ਪਕਵਾਨਾਂ ਨੂੰ ਬਣਾਉਣ ਦੀਆਂ ਵੱਖ ਵੱਖ ਤਰ੍ਹਾਂ ਦੇ ਤਰੀਕੇ ਹਨ ਮੇਰੇ ਮੈਂ ਜੋ ਵੀ ਚੀਜ਼ਾਂ ਪੰਜਾਬ ਦੇ ਨਾਲ ਸੰਬੰਧਿਤ ਹਨ ਜਿਵੇਂ ਕਿ ਦਾਲਾਂ ਸਬਜ਼ੀਆਂ ਜਿਨ੍ਹਾਂ ਵਿੱਚ ਪੰਜਾਬੀ ਮਸਾਲੇ ਪੈਂਦੇ ਹਨ ਨੂੰ ਬਹੁਤ ਚੰਗੀ ਤਰ੍ਹਾਂ ਪਕਾ ਲੈਂਦੀ ਹਾਂ ਪਰ ਜਦੋਂ ਮੈਨੂੰ ਕੋਈ ਬਾਹਰ ਦੀ ਡਿਸ਼ ਬਣਾਉਣੀ ਪੈਂਦੀ ਹੈ ਤਾਂ ਮੈਨੂੰ ਇਸ ਨੂੰ ਬਣਾਉਣ ਲਈ ਇੰਟਰਨੈੱਟ ਦੀ ਸਹਾਇਤਾ ਲੈਣੀ ਪੈਂਦੀ ਹੈ ਅਤੇ ਮੈਂ ਬਹੁਤ ਸਾਰੇ ਪਕਵਾਨ ਬਹੁਤ ਚੰਗੀ ਤਰ੍ਹਾਂ ਅਤੇ ਬਹੁਤ ਵਧੀਆ ਬਣਾ ਲੈਂਦੀ ਹਾਂ ਅਤੇ ਬਹੁਤ ਘੱਟ ਹੀ ਸਮੇਂ ਵਿੱਚ ਬਣਾ ਲੈਂਦੀ ਹਾਂ ਪਰ ਮੈਨੂੰ ਸਭ ਤੋਂ ਔਖਾ ਬਣਾਉਣਾ ਮੱਕੀ ਅਤੇ ਸਰ੍ਹੋਂ ਦਾ ਸਾਗ ਲੱਗਦਾ ਹੈ ਅਤੇ ਮੱਕੀ ਦੀ ਰੋਟੀ ਲੱਗਦੀ ਹੈ ਕਿਉਂਕਿ ਇਹ ਬਣਾਉਣ ਲਈ ਇੱਕ ਬੰਦੇ ਕੋਲ ਬਹੁਤ ਚੰਗਾ ਅਨੁਭਵ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਕਿਉਂਕਿ ਸਾਗ ਨੂੰ ਬਣਾਉਣ ਤੋਂ ਪਹਿਲਾਂ ਇਸ ਨੂੰ ਸਾਫ਼ ਕਰਨਾ ਪੈਂਦਾ ਹੈ ਅਤੇ ਇਸ ਨੂੰ ਬਣਾਉਣ ਲਈ ਲਗਭਗ ਤਿੰਨ ਤੋਂ ਚਾਰ ਘੰਟੇ ਲੱਗ ਜਾਂਦੇ ਹਨ